ਇੱਕ ਲੇਖਕ ਦੀ ਹਮੇਸ਼ਾ ਇਹ ਸੋਚ ਹੁੰਦੀ ਹੈ ਕਿ ਉਹ ਆਪਣੇ ਸ਼ਬਦਾਂ ਨੂੰ ਸਹੀ ਰੂਪ ਦੇ ਕੇ ਇੱਕ ਕਵਿਤਾ ਜਾਂ ਗੀਤ ਨੂੰ ਜੋ ਵੀ ਵਿਸ਼ੇ ਉਹ ਚੁਣਦਾ ਹੈ ਉਹਨੂੰ ਸਹੀ ਰੂਪ ਦੇ ਵਿੱਚ ਸਾਰਿਆਂ ਦੇ ਅੱਗੇ ਪੇਸ਼ ਕਰੇ ਅਤੇ ਜੋ ਵੀ ਉਹਨੇ ਇੱਕ ਵਿਸ਼ਾ ਲਿੱਤਾ ਹੁੰਦਾ ਹੈ ਤਾਂ ਉਸ ਵਿਸ਼ੇ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇ ਅਤੇ ਮੈਨੂੰ ਮੇਰੀ ਲਿਖਤ ਦਾ ਸਮਰਥਨ ਹੋਰ ਲੇਖਕ ਅਤੇ ਕਵਿੱਤਰੀਆਂ ਵੱਲੋਂ ਪ੍ਰਾਪਤ ਹੋਇਆ ਜਿਨ੍ਹਾਂ ਤੋਂ ਮੈਨੂੰ ਬਹੁਤ ਜ਼ਿਆਦਾ ਪ੍ਰੋਤਸਾਹਨ ਮਿਲਿਆ ਹੋਰ ਅੱਛਾ ਲਿਖਣ ਵਾਸਤੇ ਅਤੇ ਆਪਣੀ ਲੇਖਣੀ ਨੂੰ ਆਪਣੀ ਆਵਾਜ਼ ਦੇ ਵਿੱਚ ਪੇਸ਼ ਕਰਨ ਵਾਸਤੇ